ਪੰਜਾਬ ਵਿੱਚ ਹਰ ਇੱਕ ਤਰ੍ਹਾਂ ਦਾ ਹਰ ਇਕ ਧਰਮ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਹੀ ਇੱਕ ਦੂਜੇ ਦੇ ਇੱਕ ਦੂਜੇ ਦੇ ਧਰਮ ਦੀ ਇੱਜ਼ਤ ਕਰਦੇ ਹਨ ਜਦੋਂ ਕੋਈ ਗੁਰਪਰਬ ਵਗੈਰਾ ਮਨਾਇਆ ਜਾਂਦਾ ਹੈ ਤਾਂ ਉੱਥੇ ਵੀ ਸਾਰੇ ਹੀ ਬੜੀ ਹੀ ਸ਼ਰਧਾ ਨਾਲ਼ ਪਹੁੰਚਦੇ ਹਨ ਅਤੇ ਆਪਣਾ ਗੁਰਦੁਆਰਿਆਂ ਵਿੱਚ ਨਤਮਸਤਕ ਹੁੰਦੇ ਹਨ ਅਤੇ ਜਦੋਂ ਹਿੰਦੂ ਧਰਮ ਦੀਆਂ ਝਾਕੀਆਂ ਵੀ ਨਿਕਲਦੀਆਂ ਹਨ ਤਾਂ ਸਾਰੇ ਹੀ ਉਹਨਾਂ ਦੇ ਝਾਕੀਆਂ ਦਾ ਸਨਮਾਨ ਕਰਦੇ ਹਨ ਅਤੇ ਜਿਹੜੀ ਸੋਭਾ ਯਾਤਰਾ ਹੈ ਉਹਦਾ ਸਵਾਗਤ ਕਰਦੇ ਹਨ ਇਸ ਤਰ੍ਹਾਂ ਨਾਲ਼ ਜਿਹੜਾ ਸਮਾਜ ਹੈ ਸਾਡਾ ਇੱਕ ਦੂਜੇ ਦੇ ਨਾਲ਼ ਜੁੜਿਆ ਰਹਿੰਦਾ ਹੈ ਅਤੇ ਇੱਕ ਦੂਜੇ ਦੇ ਦੁੱਖਾਂ ਦਾ ਸਾਂਝੀ ਬਣਿਆ ਰਹਿੰਦਾ ਹੈ ਇਸ ਨਾਲ਼ ਜਿਹੜੀ ਨੈਤਿਕਤਾ ਹੈ ਉਹ ਵੀ ਆਪਣੇ ਸਮਾਜ ਵਿੱਚ ਆਪਾਂ ਹਾਂ ਆਪਣੇ ਸਥਾਨਕ ਜਿਹੜੇ ਸੱਭਿਆਚਾਰ ਅਤੇ ਭਾਈਚਾਰਾ ਹੈ ਇਸ ਨਾਲ਼ ਵੱਧਦਾ ਹੈ